ਜਿਵੇਂ ਕਿ ਸਾਡੇ ਖੇਤਰ ਵਿੱਚ ਛਪਾਉਣ ਵਾਲੀਆਂ ਆਰਟ ਗੈਲਰੀ ਚਲੀਆਂ ਕਿ ਗੌਰਮੈਂਟ ਮਯੂਜ਼ਿਯਮ ਆਰਟ ਗੈਲਰੀ ਚੰਡੀਗੜ ਜਿੱਥੇ ਕਲੈਕਸ਼ਨਜ਼ ਗੰਦਾਰਨਸ ਕਲਚਰਸ ਦੀ ਸਕਲਚਰ ਦੀ ਇੰਸ਼ੀਐਟ ਪਹਾੜੀ ਰਾਜਸਥਾਨ ਦੀ ਮੀਨੀਏਚਰ ਪੇਂਟਿੰਗਸ ਦੀਆਂ ਇਹਦੀ ਘਰ ਦੀ ਹੋਂਦ ਐਗਜਿਸਟੈਂਟ ਹੈ ਇੰਡੀਆ ਦੀ ਵੰਡ ਤੋਂ ਪਾਰਟ ਪਾਰਟੀਸ਼ਨਸ ਤੋਂ ਬਾਅਦ ਇੱਥੇ ਕਲੈਕਸ਼ਨ ਕੀਤੀ ਸੀ ਆਰਟ ਓਬਜੈਕਟਸ ਪੇਟਿੰਗਸ ਦੀ ਜਿਵੇਂ ਕਿ ਸੈਂਟਰਲ ਮਿਊਜ਼ਿਮ ਲਾਹੌਰ ਵਿੱਚ ਘਰ ਸੀ ਇਹਦਾ ਜਿਹੜਾ ਸੀ ਓਦੋੋਂ ਕੈਪੀਟਲ ਪੰਜਾਬ ਦਾ ਇਸ ਮਿਊਜ਼ੀਅਮ ਕੋਲ ਲਾਰਜੈਸਟ ਕਲੈਕਸ਼ਨ ਸੀ ਗੰਧਾਰਨ ਆਰਟਫੈਟਸ ਦੀ ਇਹਦਾ ਆਰਟੀਟੈਕ ਲੀ ਕੋਰਬੂਜ਼ਿਅਰ ਸੀ ਅਪ ਕਲੈਕਸ਼ਨ ਐਜ ਆ ਪਰੋਕਸੀਮੇਟਲੀ ਟੈਂਨ ਥਾਊਜੈਂਡ ਸੀਨਿਊਮਾਏ ਅਤੇ ਇਹਦੇ ਓਨਰ ਕੋਣ ਸੀ ਚੰਡੀਗੜ ਦਾ ਐਡਮਿਨਿਸਟ੍ਰੇਸ਼ਨ ਸੀ ਜਿਹੜਾ ਮਿਊਜ਼ੀਅਮ ਹੈ ਇਹ ਛੇ ਮਈ ਨਾਈਟੀਨ ਸਿਕਸਟੀ ਏਟ ਡਾਕਟਰ ਐਮ ਐੱਸ ਰੰਧਾਵਾ ਦੁਆਰਾ ਇਨੋਗ੍ਰੇਟਿਡ ਸੀਗਾ ਜਦ ਕਿ ਚੀਫ ਕਮਿਸ਼ਨਰ ਸੀ ਚੰਡੀਗੜ ਦਾ ਉਸ ਤੋਂ ਬਾਅਦ ਪਾਰਟੀਸ਼ਨ ਹੋਣ ਤੋਂ ਬਾਅਦ ਜਿਹੜੀ ਇਹ ਕਲੈਕਸ਼ਨਸ ਦੀ ਡਿਵੀਜ਼ਨ ਕੀਤੀ ਗਈ ਸੀ ਉਹ ਤਰੀਕ ਸੀ ਦਸ ਅਪਰੈਲ ਨਾਈਟੀਨ ਫੋਟੀ ਏਟ ਸਿਕਸਟੀ ਪ੍ਰਸੈਂਟ ਜਿਹੜੇ ਉਬਟੇਨ ਸੀ ਓਬਜੈਕਟ ਸੀ ਉਹ ਪਾਕਿਸਤਾਨ ਵਿੱਚ ਹੀ ਰਹਿ ਗਏ ਸੀ ਅਤੇ ਚਾਲੀ ਪ੍ਰਤੀਸ਼ਤ ਅਜਿਹੇ ਕਲੈਕਸ਼ਨ ਜਿਹੜੇ ਕਿ ਇੰਡੀਆ ਵਿੱਚ ਸ਼ੇਅਰ ਵਿੱਚ ਡਿੱਗ ਚੁੱਕੇ ਸੀ